ਅੱਜ ਦੇ ਸਮੇਂ ਦੇ ਵਿੱਚ ਸਭ ਦੇ ਅਲੱਗ ਅਲੱਗ ਸ਼ੌਂਕ ਨੇ ਜਿਵੇਂ ਕਿ ਕਿਸੇ ਦਾ ਨੱਚਣਾ ਸ਼ੌਂਕ ਹੁੰਦਾ ਹੈ ਕਿਸੇ ਦਾ ਪਿੱਕਚਰਾਂ ਨੂੰ ਤਸਵੀਰਾਂ ਨੂੰ ਬਣਾਉਣਾ ਹੁੰਦਾ ਹੈ ਕਿਸੇ ਦਾ ਗਾਉਣਾ ਸ਼ੌਂਕ ਹੁੰਦਾ ਹੈ ਇਸ ਦੇ ਨਾਲ ਨਾਲ ਮੇਰਾ ਵੀ ਇਹ ਸ਼ੌਂਕ ਹੈ ਕਿ ਮੈਨੂੰ ਗਾਉਣਾ ਬਹੁਤ ਜ਼ਿਆਦਾ ਪਸੰਦ ਹੈ ਇਸ ਦੀ ਸ਼ੁਰੂਆਤ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਵਿੱਚ ਕੀਤੀ ਸੀ ਕਿਉਂਕਿ ਮੈਂ ਸਕੂਲ ਦੇ ਵਿੱਚ ਜ਼ਿਆਦਾਤਰ ਆਪਣੇ ਜਦੋਂ ਸਵੇਰ ਦੇ ਟਾਈਮ ਪ੍ਰਾਥਨਾ ਕਰਦੇ ਸੀ ਤਾਂ ਮੈਂ ਹਮੇਸ਼ਾਂ ਪ੍ਰਾਥਨਾ ਦੇ ਵਿੱਚ ਜ਼ਰੂਰ ਹਿੱਸਾ ਲੈਂਦੀ ਸੀ ਮੈਂ ਆਪਣੇ ਜਦੋਂ ਸਾਡੇ ਸਕੂਲ ਦੇ ਵਿੱਚ ਸੁਬਹਾ ਆਉਣਾ ਅਤੇ ਮੈਂ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਜਾਣਾ ਤਾਂ ਜੋ ਕਿ ਮੈਂ ਆਪਣੀ ਪ੍ਰਾਰਥਨਾ ਦੇ ਵਿੱਚ ਜੋ ਕਿ ਹਿੱਸਾ ਲੈ ਸਕਾਂ ਜਦੋਂ ਮੈਂ ਹਿੱਸਾ ਲੈਂਦੀ ਸੀ ਤਾਂ ਮੇਰੀ ਟੀਚਰਸ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਦੇ ਸੀ ਕਿ ਮੇਰੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਅਤੇ ਸੁਰੀਲੀ ਹੈ ਜਿਸ ਦੇ ਕਾਰਨ ਉਹਨਾਂ ਨੇ ਮੈਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਇਸ ਚੀਜ਼ ਨੂੰ ਕਿਹਾ ਕਿ ਬੇਟਾ ਤੈਨੂੰ ਇਸ ਇਹਨਾਂ ਚੀਜ਼ਾਂ ਤੇਰੀ ਆਵਾਜ਼ ਬਹੁਤ ਜ਼ਿਆਦਾ ਸੁਰੀਲੀ ਆ ਤਾਂ ਤੈਨੂੰ ਇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਨੇ ਇਸ ਦੇ ਨਾਲ ਨਾਲ ਮੈਨੂੰ ਇੱਕ ਗਾਇਕੀ ਦਾ ਸਬਜੈਕਟ ਜੋ ਕਿ ਸ ਦਿੱਤਾ ਹਿੱਸਾ ਹਿੱਸਾ ਲੈਣ ਲਈ ਮੈਨੂੰ ਚੁਣ ਕੇ ਦਿੱਤਾ ਕਿ ਤੂੰ ਇਸ ਦੇ ਵਿੱਚ ਹਿੱਸਾ ਲੈ ਅਤੇ ਮੈਨੂੰ ਇੱਕ ਵਿਸ਼ਾ ਹੈ ਜੋ ਕਿ ਗਾਇਕੀ ਦਾ ਉਸਦੇ ਵਿੱਚ ਮੈਨੂੰ ਹੌਂਸਲਾ ਦਵਾਇਆ ਇਸ ਤੇ ਬਿਨ੍ਹਾਂ ਇਸਦੇ ਨਾਲ ਨਾਲ ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਹੌਂਸਲਾ ਦਿੱਤਾ ਜਿਸ ਦੇ ਨਾਲ ਨਾਲ ਕਿ ਮੈਂ ਆਪਣੀ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਹੁੰਦੀ ਰਹੀ ਮੈਂ ਹੌਲੀ ਹੌਲੀ ਸਕੂਲ ਦੇ ਵਿੱਚ ਪੀਰੀਅਡ ਵਗੈਰਾ ਲਗਾਉਂਦੀ ਉਸਦੇ ਬਾਅਦ ਮੈਂ ਇਸ ਦੇ ਨਾਲ ਨਾਲ ਪੀਰੀਅਡ ਲਗਾਉਣ ਤੋਂ ਬਾਅਦ ਮੈਂ ਆਪਣੇ ਘਰਾ ਘਰ ਦੇ ਵਿੱਚ ਵੀ ਜਾਣਾ ਕੰਮ ਕਰਦੇ ਨਾਲ ਨਾਲ ਗੁਣਗਾਨ ਕਰਨਾ ਜਿਸ ਦੇ ਨਾਲ ਮੇਰੀ ਆਵਾਜ਼ ਬਹੁਤ ਜ਼ਿਆਦਾ ਤੇਜ਼ ਤੇਜ਼ ਅਤੇ ਬਹੁਤ ਜ਼ਿਆਦਾ ਸਾਫ਼ ਹੁੰਦੀ ਗਈ ਇਸ ਦੇ ਨਾਲ ਨਾਲ ਮੈਨੂੰ ਸਕੂਲ ਦੇ ਵਿੱਚ ਉਹਨਾਂ ਨੇ ਸਾਜ਼ ਵਗੈਰਾ ਵਜਾਉਣੇ ਵੀ ਬਹੁਤ ਸਾਰੇ ਸਿਖਾਏ ਜਿਸ ਦੇ ਨਾਲ ਨਾਲ ਕਿ ਮੈਨੂੰ ਆਪਣੇ ਸਾਜ਼ ਦੇ ਨਾਲ ਆਪਣੀ ਜੋ ਕੁਛ ਹੁੰਦਾ ਹੈ ਉਹਦੇ ਨਾਲ ਮੈਂ ਆਪਣੇ ਆਪ ਜੋ ਕਿ ਆਪਣੀ ਟਿਊਨ ਨੂੰ ਜੋ ਕਿ ਸੈੱਟ ਕਰਦੀ ਸੀ ਜਿਸ ਦੇ ਨਾਲ ਮੈਨੂੰ ਬਹੁਤ ਆਸਾਨੀ ਰਹਿੰਦੀ ਸੀ ਤਾਂ ਜੋ ਕਿ ਜੋ ਵੀ ਮੈਨੂੰ ਕੋਈ ਟੋਪਿਕ ਦਿੱਤਾ ਜਾਂਦਾ ਸੀ ਕਿ ਤੁਸੀਂ ਇਸ ਗਾਣ ਇਸ ਇਸ ਗਾਣੇ ਨੂੰ ਇਸ ਤਰ੍ਹਾਂ ਗਾਉਣਾ ਮੈਂ ਉਸ ਨੂੰ ਉਸ ਗਾਣੇ ਨੂੰ ਉਸ ਤਰ੍ਹਾਂ ਗਾ ਸਕਦੀ ਸੀ ਉਸਦੇ ਨਾਲ ਨਾਲ ਕਿ ਮੈਨੂੰ ਉਸਦੇ ਨਾਲ ਨਾਲ ਮੈਨੂੰ ਬਹੁਤ ਸਾਰੇ ਟੀਚਰਾਂ ਨੇ ਹੌਂਸਲਾ ਦਿੱਤਾ ਜਿਸ ਦੇ ਨਾਲ ਨਾਲ ਮੈਨੂੰ ਹੌਂਸਲਾ ਅਫਜ਼ਾਈ ਕੀਤੀ ਜਿਸ ਨਾਲ ਮੈਂ ਬਹੁਤ ਜ਼ਿਆਦਾ ਮਤਲਬ ਕਿ ਅੱਜ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਆ ਚੁੱਕੀ ਹਾਂ ਜਿਸ ਉਸ ਦਾ ਸਾ ਉਸ ਦੇ ਨਾਲ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਇਸ ਨੂੰ ਇਸ ਗਾਇਕੀ ਨੂੰ ਇਸ ਲੈਵਲ ਦੇ ਉੱਤੇ ਲੈ ਕੇ ਆ ਚੁੱਕੀ ਹਾਂ ਜਿਸ ਦੇ ਹਿਸਾਬ ਦੇ ਨਾਲ ਨਾਲ ਅੱਜ ਕੱਲ੍ਹ ਦੇ ਲੋਕ ਹੈ ਜੋ ਕਿ ਗਾਣਾ ਸੁਣਨਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਬੱਚੇ ਬੁੱਢੇ ਵੱਡੇ ਬਜ਼ੁਰਗ ਨੌਜਵਾਨ ਨੌਜਵਾਨ ਅੱਜ ਕੱਲ੍ਹ ਕਾਰਾਂ ਦੇ ਵਿੱਚ ਉੱਚੀ ਉੱਚੀ ਗਾਣੇ ਲਗਾ ਕੇ ਸੁਣਦੇ ਨੇ ਉਸਦੇ ਨਾਲ ਨਾਲ ਕੀ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਪ੍ਰਦਾਨ ਹੁੰਦੀ ਹੈ ਅਤੇ ਉਹਨਾਂ ਦਾ ਜੋ ਕਿ ਜੋ ਕਿਸੇ ਚੀਜ਼ ਦਾ ਸਫ਼ਰ ਕਿਤੇ ਜਾ ਰਹੇ ਤਾਂ ਉਹਨਾਂ ਨੂੰ ਸਫ਼ਰ ਹੈ ਕਿ ਉਹ ਆਸਾਨੀ ਨਾਲ ਪਾਰ ਹੋ ਜਾਂਦਾ ਹੈ ਇਸ ਦੇ ਨਾਲ ਮੈਂ ਆਪਣੇ ਆਪਣੇ ਜੋ ਲਾਈਫ ਦਾ ਜੋ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਸਭ ਕੁਛ ਸਿੱਖਿਆ ਹੈ ਉਹ ਆਪਣੇ ਟੀਚਰਾਂ ਤੋਂ ਸਿੱਖਿਆ ਸੀ ਤਾਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਂਸਲਾ ਕੀਤਾ ਉਸ ਦੇ ਨਾਲ ਨਾਲ ਮੈਂ ਆਪਣੇ ਗਾਣਿਆਂ ਨੂੰ ਬਹੁਤ ਹੈ ਅੱਜ ਕਿਉਂਕਿ ਇਸ ਦੇ ਨਾਲ ਨਾਲ ਕੀ ਵੀ ਆਪਣੇ ਜੋ ਦਿਲ ਦੇ ਵਿੱਚ ਗੱਲ ਹੁੰਦੀ ਹੈ ਜੇ ਆਪਾਂ ਦੁਖੀ ਹਾਂ ਆਪਾਂ ਉਸ ਤਰ੍ਹਾਂ ਦਾ ਗਾਣਾ ਗਾਂਦੇ ਹਾਂ ਤਾਂ ਜਿਵੇਂ ਆਪਾਂ ਦੂਸਰੇ ਬੰਦੇ ਨੂੰ ਉਸ ਚੀਜ਼ ਨੂੰ ਫੀਲ ਕਰਾ ਵੀ ਆਪਾਂ ਉਸ ਬੰਦੇ ਨੂੰ ਸਮਝਾ ਸਕਦੇ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਆਪਾਂ ਗਾਣਾ ਗਾਉਂਦੇ ਉਸ ਹਿਸਾਬ ਦੇ ਨਾਲ ਉਸਨੂੰ ਸਮਝ ਆ ਜਾਂਦਾ ਹੈ ਕਿ ਬਈ ਇਸ ਤਰ੍ਹਾਂ ਦਾ ਮੈਨੂੰ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਅਗਰ ਮੈਂ ਕੋਈ ਦੁਖੀ ਗਾਣਾ ਗਾਉਂਦੀ ਹਾਂ ਜਾਂ ਮੈਂ ਦੁਖੀ ਕੋਈ ਗਾਣਾ ਖੁਦ ਲਿਖਦੀ ਹਾਂ ਉਸ ਨੂੰ ਬਾਅਦ 'ਚ ਗਾਉਂਦੀ ਹਾਂ ਤਾਂ ਉਸਨੂੰ ਲੋਕ ਸੁਣਦੇ ਨੇ ਤਾਂ ਉਹਨਾਂ ਨੂੰ ਵੀ ਇਦਾਂ ਲੱਗਦਾ ਕਿ ਮੇਰੇ ਨਾਲ ਵੀ ਇੱਦਾਂ ਹੋਇਆ ਸੀ ਤਾਂ ਉਹ ਇਸ ਚੀਜ਼ ਸੇਮ ਚੀਜ਼ਾਂ ਨੂੰ ਫੀਲ ਕਰਦੇ ਨੇ ਸੇਮ ਚੀਜ਼ਾਂ ਨੂੰ ਸਮਝਦੇ ਨੇ ਅਤੇ ਜਿਸ ਨਾਲ ਕੀ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਸਮਝ ਸਕਦਾ ਹੈ ਆਸਾਨੀ ਦੇ ਨਾਲ ਅਗਰ ਜੇ ਕੋਈ ਖੁਸ਼ੀ ਵਾਲਾ ਗਾਣਾ ਅਸੀਂ ਲਿਖਦੇ ਹਾਂ ਦੈਨ ਉਸਨੂੰ ਗਾਉਂਦੇ ਹਾਂ ਉਹਤੋਂ ਬਾਅਦ ਕਿ ਲੋਕ ਉਸਨੂੰ ਸੁਣ ਕੇ ਅਤੇ ਆਪਣੀ ਖੁਸ਼ੀ ਬਿਆਨ ਕਰਦੇ ਨੇ ਕਿ ਖੁਸ਼ੀ ਬਿਆਨ ਕਰ ਸਕਦੇ ਨੇ ਇਹਦੇ ਨਾਲ ਅਤੇ ਅਗਰ ਕੋਈ ਦੁੱਖ ਵਾਲਾ ਗਾਣਾ ਸੁਣਦੇ ਉਸ ਨਾਲ ਆਪਾਂ ਦੁਖੀ ਦੁੱਖ ਨੂੰ ਪ੍ਰਗਟ ਕਰ ਸਕਦੇ ਹਾਂ ਇੱਕ ਦੂਸਰੇ ਦੇ ਸਾਹਮਣੇ ਅਤੇ ਇਸਨੂੰ ਸਮਝਣਾ ਬਹੁਤ ਅਸਾ ਆਸਾਨ ਅਤੇ ਸੌਖਾ ਤਰੀਕਾ ਹੈ ਇਸ ਨਾਲ ਨਾ ਕਿਸੇ ਬੰ ਕਿਸੇ ਵਿਅਕਤੀ ਨੂੰ ਆਪਣੀ ਜੋ ਤਰੀਕਾ ਜਿਵੇਂ ਕਿ ਆਪਣਾ ਮਨ ਦੇ ਅੰਦਰ ਜੋ ਚੱਲ ਰਿਹਾ ਉਸਨੂੰ ਸਮਝਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਤੇ ਸੰਗੀਤ ਇੱਕ ਬਹੁਤ ਵਧੀਆ ਚੀਜ਼ ਹੈ ਜੋ ਕਿ ਅੱਜ ਕੱਲ੍ਹ ਸਾਰੇ ਲੋਕ ਬੱਚੇ ਵੱਡੇ ਨੌਜਵਾਨ ਆਮ ਤੌਰ 'ਤੇ ਇਸ ਨੂੰ ਗਾਉਂਦੇ ਹੀ ਹਨ ਅਤੇ ਸੰਗੀਤ ਬਹੁਤ ਜ਼ਿਆਦਾ ਵਧੀਆ ਇਹ ਮੇਰਾ ਬਹੁਤ ਵੱਡਾ ਸ਼ੌਕ ਸੀ ਜੋ ਕਿ ਮੈਂ ਆਪਣੇ ਟੀਚਰਸ ਤੋਂ ਲੈ ਕੇ ਆਪਣੇ ਪੇਰੈਂਟਸ ਦੀ ਸਹਾਇਤਾ ਦੇ ਨਾਲ ਮੈਂ ਇਸਨੂੰ ਪ੍ਰਾਪਤ ਕੀਤਾ ਹੈ ਧੰਨਵਾਦ